ਹਾਂਜੀ ਖੂਹ 'ਚੋ ਪਾਣੀ ਕੱਢਣਾ ਤਾਂ ਉਸ ਬਾਰੇ ਤੁਹਾਡੇ ਕੋਲ ਹੈਗੀ ਇੱਕ ਇਲੈਕਟਰਿਕ ਮੋਟਰ ਤਾਂ ਇਲੈਕਟਰਿਕ ਮੋਟਰ ਨਾਲ ਦੋ ਤਿੰਨ ਡਿਫਰੈਂਟ ਮੈਥਡ ਨਾਲ ਅਸੀਂ ਖੂਹ 'ਚੋਂ ਪਾਣੀ ਕੱਢ ਸਕਦੇ ਹਾਂ ਪਹਿਲਾਂ ਤਾਂ ਇਹ ਹੈ ਵੀ ਟਰਡੀਸ਼ਨ ਮੈਥਡ ਨਾਲ ਅਸੀਂ ਇੱਕ ਬਕਟ ਜਾਂ ਬਾਲਟੀ ਦੇ ਨਾਲ ਇੱਕ ਰੱਸੀ ਬੰਨ ਕੇ ਲਟਕਾ ਦਿੰਨੇ ਆ ਮੋਟਰ ਦੇ ਅੱਗੇ ਇੱਕ ਪੁਲੀ ਲਗਾ ਦਿੰਨੇ ਆ ਜਦੋਂ ਅਸੀਂ ਰੱਸੀ ਨੂੰ ਲਟਕਾਵਾਂਗੇ ਖੂਹ ਦੇ ਵਿੱਚ ਤਾਂ ਉਸ ਤੋਂ ਬਾਅਦ ਪਾਣੀ ਨੂੰ ਖਿੱਚਣ ਵਾਸਤੇ ਬਾਹਰ ਮੋਟਰ ਚਲਾ ਦਵਾਂਗੇ ਤਾਂ ਰੱਸੀ ਜਿਹੜੀ ਹੈ ਪੁਲੀ ਦੇ ਉੱਤੇ ਇਕੱਠੀ ਹੋ ਜਾਏਗੀ ਅਤੇ ਪਾਣੀ ਜਿਹੜਾ ਸਾਡੀ ਬਕਟ ਬਾਹਰ ਆ ਜਾਏਗੀ ਉਸ ਤੋਂ ਬਾਅਦ ਦੁਬਾਰਾ ਅਸੀਂ ਉਸ ਨੂੰ ਖੂਹ ਦੇ ਵਿੱਚ ਬਾਲਟੀ ਨੂੰ ਸਮੇਤ ਰੱਸੀ ਸੁੱਟ ਦਵਾਂਗੇ ਅਤੇ ਉਹ ਜਦੋਂ ਪਾਣੀ ਭਰ ਗਿਆ ਫਿਰ ਮੋਟਰ ਨੂੰ ਚਲਾ ਕੇ ਅਸੀਂ ਜਿਹੜੀ ਰੱਸੀ ਹੈ ਪੁਲੀ ਦੇ ਉੱਪਰ ਇਕੱਠੀ ਹੋ ਜਾਏਗੀ ਇਕੱਠੀ ਹੋ ਕੇ ਰੱਸੀ ਬਾਲਟੀ ਉੱਪਰ ਨੂੰ ਆਉਂਦੀ ਰਹੇਗੀ ਜਦੋਂ ਬਾਲਟੀ ਖੂਹ 'ਚੋਂ ਬਾਹਰ ਆ ਗਈ ਅਸੀਂ ਉਸ ਨੂੰ ਪਕੜ ਕੇ ਜਿੱਥੇ ਵੀ ਪਾ ਵਾਟਰ ਜਾਂ ਪਾਣੀ ਕੋਲੈਕਟ ਕਰਨਾ ਉਹਦੇ ਵਿੱਚ ਪਾ ਲਵਾਂਗੇ ਅਤੇ ਉਸ ਤੋਂ ਬਾਅਦ ਫਿਰ ਉਸ ਨੂੰ ਇੱਦਾਂ ਪ੍ਰੋਸੈਸ ਰਿਪੀਟ ਕਰੀ ਜਾਵਾਂਗੇ ਉਸ ਤੋਂ ਬਿਨਾਂ ਕਈ ਹੋਰ ਆਟੋਮੈਟਿਕ ਮੈਥਡ ਵੀ ਲੱਗ ਸਕਦੇ ਆ ਜਿਹਦੇ ਵਿੱਚ ਅਸੀਂ ਕੋਈ ਦੋ ਤਿੰਨ ਬਕਟ ਜੋੜ ਕੇ ਵੀ ਅਸੀਂ ਖੂਹ ਦੇ ਵਿੱਚੋਂ ਪਾਣੀ ਕੱਢ ਸਕਦੇ ਹਾਂ ਅਤੇ ਉਹ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦੀ ਸਾਡੀ ਰਿਕੁਆਇਰਮੈਂਟ ਹੈਗੀ ਉਸ ਤਰੀਕੇ ਨਾਲ ਅਸੀਂ ਮੋਟਰ ਨੂੰ ਵਰਤ ਕੇ ਖੂਹ ਦੇ ਵਿੱਚੋਂ ਜਿਹੜਾ ਪਾਣੀ ਆ ਬਾਹਰ ਕੱਢ ਸਕਦੇ ਹਾਂ ਧੰਨਵਾਦ